ਸਾਡਾ ਧਰਮ ਸਿੱਖ ਹੈ ਅਤੇ ਧਰਮ ਸਿੱਖ ਦੇ ਧਰਮ ਸਿੱਖ ਦੇ ਹਿਸਾਬ ਨਾਲ ਸਾਡੇ ਸਮਾਜ ਦੇ ਵਿੱਚ ਸਮਾਜ ਸੇਵਾ ਦਾ ਬਹੁਤ ਕੁਛ ਸਿਖਾਉਂਦਾ ਹੈ ਸਾਨੂੰ ਅਤੇ ਇਸ ਤੋਂ ਤੁਸੀਂ ਪਤਾ ਲੱਗਦਾ ਹੈ ਕਿ ਕਿਵੇਂ ਭਾਈ ਘਨ੍ਹੱਈਆ ਜੀ ਨੇ ਆਪਣਿਆਂ ਦੀ ਮੱਲ੍ਹਮ ਪੱਟੀ ਕਰੀ ਪਾਣੀ ਪਿਲਾਇਆ ਅਤੇ ਦੁਸ਼ਮਣਾਂ ਦੀ ਵੀ ਮੱਲ੍ਹਮ ਪੱਟੀ ਕਰੀ ਏ ਅਤੇ ਉਹਨਾਂ ਨੂੰ ਵੀ ਪਾਣੀ ਪਿਲਾਇਆ ਅਤੇ ਇੱਕ ਹੋਰ ਸਮਾਜ ਸੇਵਾ ਸਿੱਖਿਆ ਦਾ ਪੁੰਨ ਹੈਗਾ ਬਾ ਭ ਭਗਤ ਪੂਰਨ ਸਿੰਘ ਜੀ ਅਤੇ ਉਹਨਾਂ ਤੋਂ ਵੀ ਸਿੱਖਿਆ ਜਾ ਮਿਲਦੀ ਹੈ ਵੀ ਸੇਵਾ ਦਾ ਕਿਆ ਮਤਲਬ ਹੈ ਕਿਆ ਅਰਥ ਹੈ ਸੇਵਾ ਦੇ ਬਾਰੇ ਤਾਂ ਇਹ ਹੀ ਹੈ ਦੇਖਿਆ ਜਾਵੇ ਆਪਣੇ ਬਾਰੇ ਅਸੀਂ ਗੱਲ ਕਰਦੇ ਐਂ ਵੀ ਚਲੋ ਕਿਸੇ ਵੀ ਬਿਮਾਰ ਦੀ ਮਦਦ ਕੀਤੀ ਜਾ ਸਕਦੀ ਹੈ ਹੈਲਪ ਕੀਤੀ ਜਾ ਸਕਦੀ ਹੈ ਕਿੰਨੀ ਕੁ ਵੀ ਥੋੜ੍ਹੀ ਕਰੋ ਬਹੁਤੀ ਕਰੋ ਜਿੰਨੀ ਵੀ ਹੋ ਸਕਦੀ ਹੈ ਅਤੇ ਉਹ ਜ਼ਰੂਰ ਕਰਨੀ ਚਾਹੀਦੀ ਹੈ ਅਤੇ ਕਿਸੇ ਲੜਕੀ ਦਾ ਕੋਈ ਮੈਰਿਜ ਵਿਆਹ ਏ ਤਾਂ ਉੱਥੇ ਵੀ ਜਿੰਨੀ ਕੁ ਸਾਡੀ ਮਦਦ ਹੋ ਸਕਦੀ ਤੁਸੀਂ ਜ਼ਰੂਰ ਕਰੋ ਅਤੇ ਬਾਕੀ ਰਾਸ਼ਨ ਹੈ ਜਿੰਨਾ ਕੁ ਸਰਦਾ ਉਨਾਂ ਕੁ ਤੁਸੀਂ ਦੇ ਸਕਦੇ ਉਸ 'ਚ ਵੀ ਮਦਦ ਹੁੰਦੀ ਹੈ ਗਰੀਬਾਂ ਦੀ ਅਤੇ ਬਾਕੀ ਕੱਪੜੇ ਜੇ ਤੁਸੀਂ ਨਵੇਂ ਨਹੀਂ ਲੈ ਸਕਦੇ ਮਹਿੰਗੇ ਹੁੰਦੇ ਹੈ ਤਾਂ ਤੁਸੀਂ ਪੁਰਾਣੇ ਕੱਪੜਿਆਂ ਨਾਲ ਵੀ ਉਸ ਗਰੀਬ ਦੀ ਮਦਦ ਕਰ ਸਕਦੇ ਹੈ ਸੇਵਾ ਕਰ ਸਕਦੇ ਹੈ ਅਤੇ ਗਰੀਬ ਬੱਚਿਆਂ ਦੀ ਪੜਾਈ ਜਿਵੇਂ ਕਿ ਕਿਤਾਬਾਂ ਹੋਗੀਆਂ ਫੀਸਾਂ ਹੋਗੀਆਂ ਇਹਨਾਂ 'ਚ ਵੀ ਤੁਸੀਂ ਉਹਨਾਂ ਦੀ ਥੋੜ੍ਹੀ ਬਹੁਤੀ ਜਿੰਨੀ ਵੀ ਹੋ ਸਕਦੀ ਹੈ ਮਦਦ ਕਰ ਸਕਦੇ ਹੈ ਅਤੇ ਹੋਰ ਵੀ ਕਈ ਤਰੀਕੇ ਹਨ ਸੇ ਸਮਾਜ ਸੇਵਾ ਦੇ ਅਤੇ ਜਿਹੜੇ ਤੁਸੀਂ ਅਪਣਾ ਸਕਦੇ ਹੋ ਇੱਕ ਇਹ ਸਮਾਜ ਸੇਵਾ ਸਾਡੇ ਧਰਮ ਦੇ ਵਿੱਚ ਇਸਦਾ ਬਹੁਤ ਬੜਾ ਅਰਥ ਹੈ ਬਹੁਤ ਬੜਾ ਸਭ ਤੋਂ ਬੜਾ ਇਸਨੂੰ ਮੁੱਖ ਸਮਾਜ ਸੇਵਾ ਦਾ ਪੁੰਨ ਮੰਨਿਆ ਜਾਂਦਾ ਹੈ ਇਸ ਲਈ ਸਮਾਜ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ ਚਾਹੇ ਥੋੜ੍ਹੀ ਕਰੋ ਚਾਹੇ ਜ਼ਿਆਦਾ ਕਰੋ